ਸਾਡੇ ਦੁਆਰਾ ਯਾਤਰਾ ਕਰਨ ਲਈ ਸਾਨੂੰ ਟੈਕਨੋਲੋਜੀ ਦੇ ਫੀਲਡ ਜਿਸ ਤਰ੍ਹਾਂ ਕਿ ਮੋਬਾਈਲ ਦੀਆਂ ਐਪਸ ਹਨ ਬਹੁਤ ਤਰ੍ਹਾਂ ਹੀ ਹੈਲਪ ਕਰਦੀ ਹੈ ਅਸੀਂ ਮੋਬਾਈਲ ਦੇ ਵਿੱਚੋਂ ਐਪ ਸਲੈਕਟ ਕਰਕੇ ਟਰੈਵਲ ਦਾ ਪੂਰਾ ਯਾਤਰਾ ਕਰਨ ਦਾ ਪੂਰਾ ਰਸ ਵੇਰਵਾ ਲੇ ਸਕਦੇ ਹਾਂ ਕਿੰਨਾ ਟਾਈਮ ਲੱਗਦਾ ਹੈ ਉਹ ਟਰੈਵਲ ਏਜੰਸੀਆਂ ਦੇ ਥਰੂ ਕਿਸ ਤਰ੍ਹਾਂ ਆਪਣਾ ਪ੍ਰੋਗਰਾਮ ਟਰੈ ਯਾਤਰਾ ਦਾ ਪੂਰਾ ਪ੍ਰੋਗਰਾਮ ਪਲੈਨ ਐਡਵਾਂਸ ਸ਼ੁਰੂ ਪਹਿਲਾਂ ਹੀ ਪਲੈਨ ਕਰ ਸਕਦੇ ਹਾਂ ਔਰ ਉਸਦੇ ਹਿਸਾਬ ਨਾਲ ਆਪਣੀ ਯਾਤਰਾ ਨੂੰ ਬੜਾ ਸੁਖਦ ਆਰਾਮਦਾਇਕ ਬਣਾ ਸਕਦੇ ਹਾਂ ਅਤੇ ਇਸ ਤਰ੍ਹਾਂ ਟੈਕਨੋਲੋਜੀ ਟਰੈਵਲ ਕਰਨ ਘਰ ਬੈਠ ਕੇ ਹੀ ਅਸੀਂ ਸਾਰੀ ਦੀ ਸਾਰੀ ਪਲੈਨਿੰਗ ਆਪਣੇ ਆਪ ਮੋਬਾਈਲ ਦੀ ਹੈਲਪ ਨਾਲ ਟੈਕਨੋਲੋਜੀ ਦੀ ਹੈਲਪ ਨਾਲ ਅਸੀਂ ਸਾਰਾ ਪਲਾਨ ਕਰ ਸਕਦੇ ਹਾਂ ਔਰ ਸਾਡੀ ਯਾਤਰਾ ਬੜੀ ਸੁਖਦ ਹੋ ਜਾਂਦੀ ਇਸ ਤਰ੍ਹਾਂ ਟੈਕ ਰੈਕੋਗਨੇਸ਼ਨ ਤੈਕਨੋਲਜੀ ਜੋ ਹੈ ਉਸ ਵਿੱਚ ਜਿਸ ਉਹ ਰੈਕੋਗਨਾਈਜ਼ ਕੀਤੀ ਹੋਈ ਔਲਰੇਡੀ ਜੋ ਪਰੂਵ ਟੈਕਨੋਲਜੀ ਹੈਗੀਆਂ ਉਹਨਾਂ ਦੇ ਥਰੂੂ ਹੀ ਸਾਡੀ ਰਹਿਣ ਸਹਿਣ ਦਾ ਜ਼ਿੰਦਗੀ ਦਾ ਪੜਚੋਲ ਕਰਨ ਦੇ ਤਰੀਕੇ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਆਦਮੀ ਘਰ ਬੈਠ ਕੇ ਕੋਈ ਪਲੈਨਿੰਗ ਜਾਂ ਕੋਈ ਫਿਊਚਰ ਪਲੈਨਿੰਗ ਨਹੀਂ ਬਣਾ ਸਕਦਾ ਸੀ ਆਉਣ ਵਾਲੇ ਯਾਤਰਾ ਦਾ ਆਉਣ ਵਾਲੇ ਔਰ ਜੋ ਜੋ ਅਵੇਲੇਬਲ ਹੈ ਸਾਧਨ ਜੋ ਅਵੇਲੇਬਲ ਹੈ ਸਾਧਨ ਜੋ ਅਵੇਲੇਬਲ ਹੈ ਉਹਨਾਂ ਬਾਰੇ ਨਹੀਂ ਪਤਾ ਹੁੰਦਾ ਸੀ ਉਹ ਹੁਣ ਅੱਜ ਬੈਠ ਕੇ ਸਾਨੂੰ ਸਾਰੀ ਦੀ ਸਾਰੀ ਜਾਣਕਾਰੀ ਇਸ ਟੈਕਨੋਲੋਜੀ ਥਰੂ ਮਿਲ ਜਾਂਦੀ ਹੈ ਅਤੇ ਅਸੀਂ ਆਪਣੇ ਲਾਈਫ ਨੂੰ ਆਪਣੇ ਟਰੈਵਲ ਯਾਤਰਾ ਨੂੰ ਬੜਾ ਸੁਖਦ ਬਣਾ ਲੈਂਦੇ ਹਾਂ